ਅਨਾਜ ਸਬਜ਼ੀਆਂ ਹਰ ਮਨੁੱਖ ਦੀ ਜ਼ਰੂਰਤ ਹੈ ਬਿਨਾਂ ਅਨਾਜ ਬਿਨਾਂ ਸਬਜ਼ੀਆਂ ਫਲ ਫਰੂਟ ਕਿਸੇ ਵੀ ਵਿਅਕਤੀ ਦਾ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਕਿਸਾਨਾਂ ਦੇ ਬਾਰੇ ਵਿੱਚ ਸੋਚਣਾ ਖੇਤੀਬਾੜੀ ਬਾਰੇ ਸੋਚਣਾ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਲੋਕਾਂ ਦਾ ਵੱਲੋਂ ਖੇਤੀਬਾੜੀ ਲਈ ਕਿਸਾਨਾਂ ਲਈ ਭਾਈਚਾਰਕ ਸਮਰਥਨ ਪ੍ਰਾਪਤ ਕਰਨ ਲਈ ਉਹਨਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਜੇਕਰ ਖੇਤੀਬਾੜੀ ਨਹੀਂ ਰਹੇਗੀ ਕਿਸਾਨ ਨਹੀਂ ਰਹਿਣਗੇ ਤਾਂ ਤੁਸੀਂ ਜ਼ਿੰਦਾ ਕਿਵੇਂ ਰਹਿ ਸਕਦੇ ਹੋ ਕਿਉਂਕਿ ਬਿਨਾਂ ਅਨਾਜ ਬਿਨਾਂ ਸਬਜ਼ੀਆਂ ਬਿਨਾਂ ਫਲ ਫਰੂਟ ਕਿਸੇ ਲਈ ਵੀ ਜ਼ਿੰਦਾ ਰਹਿਣਾ ਸੰਭਵ ਨਹੀਂ ਹੋਵੇਗਾ ਅਜਿਹੇ ਵਿਚਾਰ ਦੇ ਕੇ ਲੋਕਾਂ ਨੂੰ ਖੇਤੀਬਾੜੀ ਲਈ ਕਿਸਾਨਾਂ ਲਈ ਭਾਈਚਾਰੇ ਦਾ ਮਾਹੌਲ ਬਣਾਇਆ ਜਾ ਸਕਦਾ ਹੈ